ਇੱਕ ਨਵੇਂ ਬੱਚੇ ਜਨਮ ਨਵੇਂ ਜੰਮੇ ਬੱਚੇ ਲਈ ਉਸ ਦੇ ਪਹਿਲੇ ਸ ਸਾਲ ਦੇ ਦੌਰਾਨ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹੈ ਜਦੋਂ ਬੱਚਾ ਨਵਾਂ ਜੰਮਿਆ ਜਾਂਦਾ ਹੈ ਤਾਂ ਉਹਦੀ ਮੰਮੀ ਨੂੰ ਅਤੇ ਬੱਚੇ ਦੇ ਤੇਰ੍ਹਾਂ ਦਿਨਾਂ ਬਾਅਦ ਉਹਦੇ 'ਤੇ ਚੋਲਾ ਪਾਇਆ ਜਾਂਦਾ ਹੈ ਫਿਰ ਇਹ ਉਸ ਨੂੰ ਮਹੀਨੇ ਬਾਅਦ ਸਵਾ ਮਹੀਨੇ ਬਾਅਦ ਉਹਦੇ 'ਤੇ ਨਵੇਂ ਕੱਪੜੇ ਪਾਏ ਜਾਂਦੇ ਹਨ ਫਿਰ ਛੇ ਮਹੀਨਿਆਂ ਬਾਅਦ ਉਹਦਾ ਮੁੰਡਨ ਕੀਤਾ ਜਾਂਦਾ ਹੈ ਨਵੇਂ ਜੰਮੇ ਬੱਚਿਆਂ ਦੀਆਂ ਕਈ ਤਰ੍ਹਾਂ ਦੀਆਂ ਹੀ ਰਸਮਾਂ ਹੁੰਦੀਆਂ ਹਨ ਨਵੇਂ ਜੰਮੇ ਬੱਚੇ ਸਾਲ ਦੇ ਵਿੱਚ ਉਹਨੂੰ ਕਈ ਤਰ੍ਹਾਂ ਦੀਆਂ ਯਾਨੀ ਕਿ ਉਹਨਾਂ ਦੀ ਪਹਿਲੀ ਲੋਹੜੀ ਵੀ ਮਨਾਈ ਜਾਂਦੀ ਹੈ ਨਵੇਂ ਜੰਮੇ ਬੱਚੇ ਦਾ ਹਰ ਇੱਕ ਦਾ ਪਹਿਲਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉਹਦੀ ਲੋਹੜੀ ਦੇ ਵਿੱਚ ਤਾਂ ਬਹੁਤ ਹੀ ਤਰ੍ਹਾਂ ਦੀਆਂ ਹੀ ਰਸਮਾਂ ਕੀਤੀਆਂ ਜਾਂਦੀਆਂ ਹਨ ਅਤੇ ਹਰ ਇੱਕ ਤਿਉਹਾਰ ਦੇ ਵਿੱਚ ਕਈ ਤਰ੍ਹਾਂ ਦੇ ਉਹਨੂੰ ਤਿਉਹਾਰ ਤਿਉਹਾਰਾਂ ਦੇ ਦੌਰਾਨ ਉਹਨੂੰ ਕਈ ਤਰ੍ਹਾਂ ਦੇ ਨਵੇਂ ਨਵੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹਦੇ ਲਈ ਇਹ ਯਾਦਗਾਰੀ ਪਲ ਬਣ ਸਕੇ ਨਵੇਂ ਜੰਮੇ ਬੱਚਿਆਂ ਕਈ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਰਹਿੰਦੀਆਂ ਹਨ ਨਵੇਂ ਜੰਮੇ ਬੱਚੇ ਵਿੱਚ ਕਈ ਤਰ੍ਹਾਂ ਦੇ ਹੀ ਕਈ ਤਰ੍ਹਾਂ ਦੀਆਂ ਹੀ ਰੀਤਾਂ ਰੀਤੀ ਰਿਵਾਜ਼ ਚੱਲਦੇ ਰਹਿੰਦੇ ਹਨ ਸਾਲ ਤੱਕ ਬੱਚੇ ਜੇ ਕਈ ਤਰ੍ਹਾਂ ਦੇ ਰੀਤੀ ਰਿਵਾਜ਼ ਚਲਾਏ ਜਾਂਦੇ ਹਨ ਇੱਕ ਸਾਲ ਤੋਂ ਪਹਿਲਾਂ ਬੱਚੇ ਦਾ ਕਿੰਨੀ ਤਰ੍ਹਾਂ ਦਾ ਹੀ ਤਿਆਰ ਕੀਤਾ ਜਾਂਦਾ ਹੈ ਨਵੇਂ ਜੰਮੇ ਬੱਚੇ ਲਈ ਰਸਮ ਦੇ ਵਿੱਚ ਕਿਸ ਤਰ੍ਹਾਂ ਨਾਲ ਕਰੇ ਜਾਂਦੇ ਹਾਂ ਨਵੇਂ ਜੰਮੇ ਬੱਚੇ ਦੇ ਲਈ ਕਈ ਤਰ੍ਹਾਂ ਦੀਆਂ ਵਿਧੀਆਂ ਵੀ ਕੀਤੀਆਂ ਜਾਂਦੀਆਂ ਹਨ ਜਾਂਦੀਆਂ ਹਨ ਧੰਨਵਾਦ